ਨਾਗਰਿਕ ਵਾਲੀ ਬੈਂਕੀ ਨੂੰ ਸੌਖਾ ਬਣਾਉਣ ਲਈ ਜਿਹੜੀਆਂ ਬੈਂਕਾਂ ਨਾਲ ਸੰਬੰਧਿਤ ਸਰਕਾਰ ਨੇ ਜਿਹੜਾ ਸਭ ਤੋਂ ਵਧੀਆ ਕੰਮ ਇਹ ਆ ਹੌਲੀ ਹੌਲੀ ਬੈਂਕ ਦੀਆਂ ਵੀ ਯੋਜਨਾਵਾਂ ਹੌਲੀ ਹੌਲੀ ਜਿਹੜਾ ਉਹਨਾਂ ਨੇ ਕੀਤਾ ਵੀ ਆਪਣੇ ਏ ਟੀ ਐੱਮ ਕਾਰਡ ਪਹਿਲੀ ਗੱਲ ਤਾਂ ਜਿੱਦਾਂ ਜੇ ਕਿਸੇ ਨੇ ਮੰਨ ਲਓ ਪੈਸੇ ਬੈਂਕ 'ਚੋਂ ਕਢਵਾਉਂਣੇ ਹੁੰਦੇ ਸੀਗੇ ਉਹਨਾਂ ਨੂੰ ਪਹਿਲਾਂ ਬੈਂਕ ਜਾਣਾ ਪੈਂਦਾ ਸੀਗਾ ਆਪਣੀ ਫਿਰ ਉਹਨਾਂ ਨੂੰ ਉੱਥੇ ਲਾਇਨ ਵਿੱਚ ਲੱਗਣਾ ਪੈਂਦਾ ਸੀ ਪਰ ਹੁਣ ਜਿਹੜੇ ਸਭ ਤੋਂ ਸੌਖਾ ਤਰੀਕੇ ਏ ਟੀ ਐੱਮ ਜ਼ਰੀਏ ਜੇ ਤੁਹਾਨੂੰ ਰਾਸਤੇ ਵਿੱਚ ਕੋਈ ਏ ਟੀ ਐੱਮ ਮਿਲ ਜਾਂਦਾ ਤੁਹਾਨੂੰ ਜ਼ਰੂਰਤ ਹੈ ਪੈਸਿਆਂ ਦੀ ਰਸਤੇ 'ਚੋਂ ਕਿਸੇ ਵੀ ਏ ਟੀ ਐੱਮ ਦੇ ਵਿੱਚ ਜਾ ਕੇ ਤੁਸੀਂ ਪੈਸੇ ਕਢਵਾ ਸਕਦੇ ਹੋ ਦੂਜੇ ਦਿਨ ਦੂਸਰੇ ਨੰਬਰ ਦੇ ਉੱਤੇ ਸਰਕਾਰ ਨੇ ਜਿਹੜਾ ਸਭ ਤੋਂ ਵਧੀਆ ਕੰਮ ਕੀਤਾ ਉਹ ਇਹ ਆ ਵੀ ਜਿਹੜਾ ਔਨਲਾਈਨ ਨੈੱਟ ਬੈਂਕਿੰਗ ਜਿਹੜਾ ਦਾ ਕੰਮ ਜਿਹੜਾ ਆ ਉਹ ਹੋ ਗਿਆ ਵੀ ਜਿੱਦਾਂ ਤੁਸੀਂ ਪੇਟੀਐੱਮ ਰਾਹੀਂ ਜਾਂ ਗੂਗਲ ਪੇ ਰਾਹੀਂ ਫੋਨਪੇ ਕਿੰਨੇ ਪਲੇਟਫਾਰਮ ਇਹੋ ਜਿਹੇ ਵੀ ਤੁਸੀਂ ਔਨਲਾਈਨ ਨੈੱਟ ਬੈਂਕਿੰਗ ਦੀ ਸਿੱਧਾ ਹੀ ਔਨਲਾਈਨ ਕਿਤੇ ਵੀ ਤੁਸੀਂ ਗਏ ਹਾਂ ਤੁਹਾਡੇ ਕੋਲ ਪੈਸੇ ਜਿਹੜੇ ਆ ਟੁੱਟੇ ਨਹੀਂ ਹੈਗੇ ਦਸਾ ਦਸਾ ਦੇ ਜਾਂ ਵੀਹਾਂ ਵੀਹਾਂ ਦੇ ਸੌ ਸੌ ਦੇ ਹੈ ਨਹੀਂ ਪੰਜ ਪੰਜ ਸੌ ਦੇ ਆ ਮੰਨ ਲਓ ਜੇ ਤੁਸੀ ਮੰਨ ਲਓ ਦਸ ਵੀਹ ਰੁਪਏ ਪੰਦਰਾਂ ਪੱਚੀ ਰੁਪਈਏ ਕਿਤੇ ਵੀ ਦੇਣੇ ਆ ਉਹਨਾਂ ਨੇ ਬਾਰਕੋਰਟਸ ਜਿਹੜਾ ਉਹਨਾਂ ਦਾ ਹੋਵੇਗਾ ਤੁਸੀਂ ਸਕੈਨ ਕਰਨਾ ਹੈ ਸਿੱਧੀ ਔਨਲਾਈਨ ਪੇਮੈਂਟ ਕਰ ਸਕਦੇ ਹਾਂ ਸਭ ਤੋਂ ਵਧੀਆ ਜਿਹੜਾ ਤਰੀਕਾ ਇਹ ਆ ਜਿਹੜਾ ਇਹ ਬੈਂਕਿੰਗ ਨੂੰ ਸੌਖਾ ਬਣਾਉਂਦਾ ਆ ਪੈਸਿਆਂ ਦੇ ਲੈਣ ਦੇਣ ਨੂੰ ਸੌਖਾ ਬਣਾਉਂਦਾ ਆ ਸੋ ਕਈ ਹੋਰ ਵੀ ਬਹੁਤ ਆਉਣ ਵਾਲੇ ਟਾਈਮ ਦੇ ਵਿੱਚ ਸਰਕਾਰ ਜਿਹੜੀ ਸਹੂਲਤਾਂ ਨਾਗਰਿਕਾਂ ਦੇ ਲਈ ਕੱਢ ਰਹੀਆਂ ਬੈਂਕ ਨਾਲ ਸੰਬੰਧਿਤ ਸੋ ਮੇਨ ਮੇਨ ਤਾਂ ਪੁਆਇੰਟ ਇਹੀ ਆ ਦੋ ਤਿੰਨ ਜਿਹੜੇ ਆ